ਹੈਲੋ ਹਾਂਜੀ ਬਾਈ ਮੇਰਾ ਨਾਂ ਜਸਪ੍ਰੀਤ ਹੈ ਮੈਂ ਤੁਹਾਨੂੰ ਕਹਿਣ ਕਹਿਣ ਦਿਆਂ ਕਿ ਤੁਹਾਨੂੰ ਮੈਂ ਕੱਲ੍ਹ ਇੱਕ ਕੈਬ ਬੁੱਕ ਕਰਵਾਈ ਸੀ ਤਰਨਤਾਰਨ ਰੋਡ ਅੰਮ੍ਰਿਤਸਰ ਤੋਂ ਲੈ ਕੇ ਦਿ ਅੰਮ੍ਰਿਤਸਰ ਏਅਰਪੋਰਟ ਜਾਣ ਲਈ ਹਾਂਜੀ ਹਾਂਜੀ ਚੈੱਕ ਕਰ ਲਓ ਠੀਕ ਹੈ ਠੀਕ ਹੈ ਮੈਂ ਤੁਹਾਨੂੰ ਕਹਿਣ ਦਿਆਂ ਕਿ ਸਵੇਰੇ ਨਾ ਤੁਸੀਂ ਜਲਦੀ ਤੋਂ ਜਲਦੀ ਆ ਜਿਓ ਸਵੇਰੇ ਪੰਜ ਜਾਂ ਛੇ ਵਜੇ ਨਹੀਂ ਆ ਸਕਦੇ ਭਾਅ ਜੀ ਮੈਂ ਤੁਹਾਨੂੰ ਕਹਿਣ ਦਿਆਂ ਕਿ ਉਹ ਸਵੇਰੇ ਨਾ ਚੱਕਾ ਜਾਮ ਕਰਕੇ ਕਿਸਾਨਾਂ ਦੇ ਕਰਕੇ ਚੱਕਾ ਜਾਮ ਕਰਕੇ ਨਾ ਲੇਟ ਨਾ ਹੋ ਸਕੀਏ ਨਾ ਤੁਸੀਂ ਸਵੇਰੇ ਜਲਦੀ ਆ ਜਿਓ ਠੀਕ ਹੈ ਠੀਕ ਹੈ ਹਾਂਜੀ ਜਲਦੀ ਆ ਜਿਓ ਅਤੇ ਨਾ ਤੁਸੀਂ ਜਲਦੀ ਆ ਮੈਨੂੰ ਨਾ ਜਦੋਂ ਤੁਸੀਂ ਘਰੋਂ ਤੁਰਨ ਲੱਗੋਗੇ ਨਾ ਤਾਂ ਮੈਨੂੰ ਇੱਕ ਵਾਰੀ ਜ਼ਰੂਰ ਕੋਲ ਕਰ ਲਿਓ ਤਾਂ ਜੋ ਮੈਂ ਤੁਹਾਨੂੰ ਦੱਸਾਂਗੇ ਕਿ ਆਪਾਂ ਸਵੇਰੇ ਲੇਟ ਨਾ ਹੋ ਸਕੀਏ ਏਅਰਪੋਰਟ ਜਾਣ ਲਈ ਅਤੇ ਹੋਰ ਮੈਨੂੰ ਇਹ ਵੀ ਦੱਸ ਦਿਓ ਕਿ ਪੈਸੇ ਕਿੰਨੇ ਹੋਣਗੇ ਠੀਕ ਠੀਕ ਠੀਕ ਹਾਂਜੀ ਹਾਂਜੀ ਸਵੇਰੇ ਆ ਜਿਓ ਅਤੇ ਮੈਂ ਤੁਹਾਨੂੰ ਨਾ ਇਹੀ ਨੰਬਰ 'ਤੇ ਨਾ ਲੋਕੇਸ਼ਨ ਸੈਂਡ ਕਰ ਦਿੰਦਾ ਇਹੀ ਨੰਬਰ ਆ ਨਾ ਜੀ ਤੁਹਾਡਾ ਠੀਕ ਠੀਕ ਹਾਂਜੀ ਅਤੇ ਮੈਂ ਤੁਹਾਨੂੰ ਸਵੇਰੇ ਇਹੀ ਲੋਕੇਸ਼ਨ ਨੰਬਰ 'ਤੇ ਸੈਂਡ ਕਰ ਦਿੰਦਾ ਅਤੇ ਤੁਸੀਂ ਇਹੀ ਸਵੇਰੇ ਜਲਦੀ ਆ ਜਿਓ ਤਾਂ ਜੋ ਆਪਾਂ ਲੇਟ ਨਾ ਹੋ ਸਕੀਏ ਧੰਨਵਾਦ